ਹੋਰ ਗ੍ਰਹਿਆਂ ਦੇ ਉੱਪਰ ਜੀਵਨ ਲੱਭਣ ਲਈ ਸਾਰੇ ਦੇਸ਼ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਇਸ ਵਿੱਚ ਸਭ ਤੋਂ ਪਹਿਲ ਜਿਹੜੀ ਕਰੀ ਤੀ ਅਮੈਰੀਕਾ ਨੇ ਕਰੀ ਤੀ ਜੋ ਉਸਨੇ ਆਪਣਾ ਗ੍ਰਹਿ ਭੇਜ ਕੇ ਚੰਦ ਦੇ ਉੱਪਰ ਜੀਵਨ ਲੱਭਣ ਦੀ ਬੇਮਿਸਾਲ ਕੋਸ਼ਿਸ਼ ਕੀਤੀ ਤੀ ਇਹਦੇ ਵਿੱਚ ਜਿਵੇਂ ਨਾਸਾ ਕ ਨਾਸਾ ਦੇ ਐਕਸਪਲੋਰ ਪ੍ਰੋਗਰਾਮ ਦਾ ਅੰਤਿਮ ਟੀਚਾ ਧਰਤੀ ਤੋਂ ਪਰੇ ਹੋਰ ਗ੍ਰਹਿ 'ਤੇ ਮੌਜੂਦਾ ਜੀਵਨ ਨੂੰ ਬੇਮਿਸਾਲ ਸੰਕੇਤਾਂ ਨੂੰ ਲੱਭਣਾ ਹੈ ਇਸ ਵਿੱਚ ਸਾਰੇ ਦੇਸ਼ ਆਪਣਾ ਹਿੱਸਾ ਪਾ ਰਹੇ ਹਨ ਜਿਵੇਂ ਕੀ ਇੰਡੀਆ ਨੇ ਵੀ ਦੋ ਵਾਰ ਆਪਣਾ ਚੰਦਰਯਾਨ ਭੇਜਿਆ ਅਤੇ ਇਹ ਇੱਕ ਵਾਰ ਪਹਿਲਾਂ ਅਤੇ ਇੱਕ ਵਾਰ ਹੁਣ ਦੋ ਹਜ਼ਾਰ ਤੇਈ ਦੇ ਵਿੱਚ ਜੋ ਸਫਲਤਾਪੂਰਕ ਉਥੇ ਪਹੁੰਚ ਗਿਆ ਅਤੇ ਚੰਦਰਯਾਨ ਦੇ ਉੱਪਰ ਚੰਦਰ ਗ੍ਰਹਿ ਦੇ ਉੱਪਰ ਸਾਨੂੰ ਪਾਣੀ ਦੇ ਸੰਕੇਤ ਮਿਲੇ ਨੇ ਜਿੱਥੋਂ ਸਾਨੂੰ ਪਤਾ ਲੱਗਦਾ ਵੀ ਇੱਥੇ ਜੀਵਨ ਸੰਭਵ ਹੈ ਅਤੇ ਚੰਦ ਦੇ ਹੋਰ ਵੀ ਕਈ ਮੇਨ ਫੈਕਟ ਨੇ ਜਿਵੇਂ ਕਿ ਸਾਨੂੰ ਚੰਦ ਹੀ ਧਰਤੀ ਤੋਂ ਚੰਦਰਮਾ ਨੂੰ ਅੱਧੇ ਤੋਂ ਥੋੜ੍ਹਾ ਹੀ ਵੱਧ ਦੇਖਦੇ ਹਾਂ ਅਤੇ ਸੂਰਜ ਦੀ ਚਮਕ ਦੇ ਬਰਾਬਰ ਹੋਣ ਲਈ ਲੱਖਾਂ ਚੰਦਰਮਾ ਸਾਨੂੰ ਲੱਗਣਗੇ ਠੀਕ ਹੈ ਜੀ ਚੰਦਰਮਾ ਤੋਂ ਦਿਖਾਈ ਦੇਣ ਵਾਲੀ ਧਰਤੀ ਵੀ ਪੜਾਵਾਂ ਵਿੱਚੋਂ ਲੰਘਦੀ ਹੈ ਚੰਦਰਮਾ ਇੱਕ ਵਿਸ਼ਾਲ ਤਾਪਮਾਨ ਦੀ ਤਾਪਮਾਨ ਨੂੰ ਘੇਰਦਾ ਹੈ